ਸਾਡੇ ਪਿੰਡ ਦੇ ਲੋਕਾਂ ਵਿੱਚ ਕਰਜਾ ਲੈਣਾ ਤਾਂ ਆਮ ਗੱਲ ਹੀ ਬਣੀ ਹੋਈ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਜ਼ਿਆਦਾਤਰ ਬੇਰੁਜ਼ਗਾਰ ਲੋਕ ਨੇ ਨੌਕਰੀ ਵੀ ਹੋਣੇ ਨੇ ਅਤੇ ਜੋ ਕਿਸਾਨ ਕਿਸਾਨੀ ਦਾ ਕੰਮ ਕਰਦੇ ਨੇ ਉਹਨਾਂ ਕੋਲ ਜ਼ਮੀਨਾਂ ਬੜੀਆਂ ਥੋੜ੍ਹੀਆਂ ਨੇ ਅਤੇ ਉਹਨਾਂ ਨੂੰ ਆਪਣੀਆਂ ਨਿੱਜੀ ਲੋੜਾਂ ਵੀ ਪੂਰੀਆਂ ਕਰਨੀਆਂ ਬੜੀ ਔਖੀਆਂ ਹੋ ਜਾਂਦੀਆਂ ਨੇ ਇਸ ਕਰਕੇ ਉਹ ਆਪਣੀਆਂ ਜੋ ਰੋਜ਼ਾਨਾ ਲੋੜਾਂ ਨੇ ਆਪਣੇ ਪਰਿਵਾਰ ਨੂੰ ਪਾਲਣਾ ਖਾਣ ਪੀਣ ਦੀਆਂ ਵਸਤਾਂ ਲੈਣੀਆਂ ਪਹਿਨਣ ਦੀਆਂ ਵਸਤਾਂ ਲੈਣੀਆਂ ਉਹਦੇ ਲਈ ਉਹਨਾਂ ਨੂੰ ਕਰਜਾ ਚੱਕਣਾ ਪੈਂਦਾ ਏ ਅਤੇ ਇਸ ਕਰਕੇ ਉਹ ਕਰਜ਼ਾ ਲੈਣ ਦੇ ਲਈ ਉਹ ਬੈਂਕਾਂ ਕੋਲ ਨਹੀਂ ਜਾਂਦੇ ਬਲਕਿ ਜੋ ਆਪਣੇ ਆੜਤੀਏ ਹੁੰਦੇ ਨੇ ਉਹਨਾਂ ਕੋਲ ਜਾਂ ਜੋ ਥੋੜ੍ਹੇ ਬਹੁਤੇ ਧਨਾੜਪੁਰਸ਼ ਨੇ ਉਹਨਾਂ ਕੋਲ ਕਰਜ਼ਾ ਲੈਣ ਦੇ ਲਈ ਉਹ ਸੰਪਰਕ ਕਰਦੇ ਨੇ ਅਤੇ ਉਹ ਆਪਣੇ ਮਨ ਮਰਜ਼ੀ ਦੇ ਜਿਹੜੇ ਰੇਟ ਨੇ ਉਹਦੇ 'ਤੇ ਕਰਜ਼ਾ ਦਿੰਦੇ ਨੇ ਉਹ ਕਿਸਾਨੀ ਪਰਿਵਾਰ 'ਚੋਂ ਨੇ ਜਿਹੜੇ ਲੋਕ ਉਹ ਤਾਂ ਆਪਣੀਆਂ ਫਸਲ ਜਦੋਂ ਵੱਢਦੇ ਨੇ ਵੇਚਦੇ ਨੇ ਉਦੋਂ ਆਪਣੇ ਚੱਕਿਆ ਹੋਇਆ ਕਰਜ਼ਾ ਆਪਣੀ ਫਸਲ ਦੀ ਕੀਮਤ ਵਿੱਚੋਂ ਹੀ ਕਟਾ ਦਿੰਦੇ ਨੇ ਅਤੇ ਇਸ ਤੋਂ ਇਲਾਵਾ ਇਹਦੇ ਵਿੱਚ ਚੰਗੇ ਇਹਦੇ ਪ੍ਰਭਾਵ ਵੀ ਨੇ ਅਤੇ ਮਾੜੇ ਵੀ ਨੇ ਚੰਗੇ ਪ੍ਰਭਾਵ ਤਾਂ ਇਹ ਨੇ ਕਿ ਲੋਕਾਂ ਦੀਆਂ ਆਪਣੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਮਾੜੇ ਪ੍ਰਭਾਵ ਜਿਹੜੇ ਜ਼ਿਆਦਾ ਖਤਰਨਾਕ ਨੇ ਉਹਨਾਂ ਵਿੱਚੋਂ ਹੈ ਕਿ ਆਤਮ ਹੱਤਿਆ ਦਾ ਜਿਹੜੇ ਕਿਸਾਨ ਜਾਂ ਗਰੀਬ ਲੋਕ ਨਿਸ਼ਚਿਤ ਸਮੇਂ ਤੱਕ ਆਪਣਾ ਕਰਜਾ ਵਾਪਸ ਨਹੀਂ ਕਰ ਸਕਦੇ ਉਹਨਾਂ ਦੇ ਮਾਨਸਿਕ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਹਦੇ ਵਿੱਚ ਉਹਨਾਂ ਨੂੰ ਅੰਤ ਨੂੰ ਉਹਨਾਂ ਨੂੰ ਆਤਮ ਹੱਤਿਆ ਦਾ ਰਾਹ ਅਖਤਿਆਰ ਕਰਨਾ ਪੈਂਦਾ ਏ